ਇੱਕ ਊਰਜਾਵਾਨ ਪੰਜਾਬੀ ਨਾਚ ਭੰਗੜਾ ਪੰਜਾਬੀ ਕਿਸਾਨਾਂ ਨਾਲ ਇੱਕ ਸੱਭਿਆਚਾਰਕ ਅਤੇ ਫਿਰਕੂ ਜਸ਼ਨ ਵਜੋਂ ਸ਼ੁਰੂ ਹੋਇਆ ਇਸ ਦੇ ਆਧੁਨਿਕ ਸਮੇਂ ਦੇ ਵਿਕਾਸ ਨੇ ਭੰਗੜੇ ਨੂੰ ਆਪਣੀਆਂ ਰਵਾਇਤੀ ਪੰਜਾਬੀ ਜੜ੍ਹਾਂ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਜਦੋਂ ਕਿ ਪ੍ਰਸਿੱਧ ਸੰਗੀਤ ਅਤੇ ਡੀਜਿੰਗ ਸਮੂਹ ਅਧਾਰਿਤ ਮੁਕਾਬਲਿਆ ਅਤੇ ਇੱਥੋਂ ਤੱਕ ਕਿ ਕਸਰਤ ਏਰੀਕਰਨ ਨੂੰ ਸ਼ਾਮਿਲ ਕਰਨ ਲਈ ਇਸਦੀ ਪਹੁੰਚ ਨੂੰ ਵਧਾਉਂਦੇ ਹਨ